ਕਈ ਇਲਾਕੇ ਇਹੋ ਜਿਹੇ ਹਨ ਜਿਹਨਾਂ ਵਿਚ ਹੋਰ ਬੋਲੀ ਬੋਲੀ ਜਾਂਦੀ ਹੈ ਜਿਵੇਂ ਪੰਜਾਬ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਰਾਜਸਥਾਨ ਵਿੱਚ ਹਿੰਦੀ ਬੋਲੀ ਜਾਂਦੀ ਹੈ ਅਤੇ ਹਰਿਆਣੇ ਵਿੱਚ ਵੀ ਹਿੰਦੀ ਬੋਲੀ ਜਾਂਦੀ ਹੈ ਅਤੇ ਹਰਿਆਣੇ ਵਿੱਚ ਸਾਡੇ ਕਈ ਰਿਸ਼ਤੇਦਾਰ ਵੀ ਹਨ ਜੋ ਕਿ ਉਹ ਆਪਦੀ ਭਾਸ਼ਾ ਹੀ ਬੋਲਦੇ ਹਨ ਹਿੰਦੀ ਅਤੇ ਉਹਨਾਂ ਦੀ ਭਾਸ਼ਾ ਵੀ ਬਹੁਤ ਹੀ ਵਧੀਆ ਹੁੰਦੀ ਹੈ ਜਿਵੇਂ ਕਿ ਸਾਡੀ ਪੰਜਾਬ ਦੀ ਭਾਸ਼ਾ ਵਧੀਆ ਪੰਜਾਬੀ ਹੁੰਦੀ ਹੈ ਅਤੇ ਉਹਨਾਂ ਦੀ ਵੀ ਹਰਿਆਣੇ ਦੀ ਭਾਸ਼ਾ ਹਿੰਦੀ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਜਦੋਂ ਮੈਂ ਹਰਿਆਣੇ ਵਿੱਚ ਮਾਸ ਜਾਂਦੀ ਹਾਂ ਰਿਸ਼ਤੇਦਾਰੀ ਵਿੱਚ ਤਾਂ ਉਹ ਆਪਦੀ ਭਾਸ਼ਾ ਹਿੰਦੀ ਬੋਲਦੇ ਆ ਅਤੇ ਮੈਨੂੰ ਉਹਨਾਂ ਦੀ ਭਾਸ਼ਾ ਸਮਝ ਆ ਜਾਂਦੀ ਆ ਅਤੇ ਉਹਨਾਂ ਨੂੰ ਵੀ ਮੇਰੀ ਭਾਸ਼ਾ ਸਮਝ ਆ ਜਾਂਦੀ ਆ ਕਈ ਸ਼ਬਦ ਹੁੰਦੇ ਆ ਜਿਹੜੇ ਕਿ ਉਹਨਾਂ ਨੂੰ ਮੇਰੀ ਸਮਝ ਨਹੀਂ ਆਉਂਦੀ ਅਤੇ ਮੈਨੂੰ ਵੀ ਉਹਨਾਂ ਦੀ ਕਈ ਸ਼ਬਦ ਸਮਝ ਨਹੀਂ ਆਉਂਦੇ ਅਤੇ ਕਈ ਇਹੋ ਜਿਹੇ ਹੁੰਦੇ ਜਿਹਨਾਂ ਨੂੰ ਦੋਵੇਂ ਭਾਸ਼ਾ ਹੀ ਸਮਝ ਆ ਜਾਂਦੀਆਂ ਹੈਗੀਆਂ ਅਤੇ ਉਹ ਅਸੀਂ ਇੱਕ ਦੂਜੇ ਤੋਂ ਪੁੱਛ ਲੈਂਦੇ ਹਾਂ ਕਿ ਇਹ ਕੀ ਕਹਿ ਰਿਹਾ ਇਹ ਕੀ ਕਹਿ ਰਿਹਾ ਇਸੇ ਤਰ੍ਹਾਂ ਹੀ ਜਿਵੇਂ ਕਿ ਕਨੇਡਾ ਵਿੱਚ ਇ ਇੰਗਲਿਸ਼ ਬੋਲੀ ਜਾਂਦੀ ਉੱਧਰਲੇ ਬੱਚੇ ਅਤੇ ਉੱਥੇ ਵੀ ਜਦੋਂ ਆਏ ਸੀ ਅਤੇ ਸਾਨੂੰ ਉਹਨਾਂ ਦੀ ਸਮਝ ਨਹੀਂ ਆਉਂਦੀ ਸੀ ਅਤੇ ਉਹਨਾਂ ਨੂੰ ਸਾਡੀ ਸਮਝ ਵੀ ਨਹੀਂ ਆਉਂਦੀ ਸੀ ਅਤੇ ਫੇਰ ਦੱਸਦੇ ਹੁੰਦੇ ਸੀ ਇਹਨਾਂ ਇੰਗਲਿਸ਼ ਤੋਂ ਪੰਜਾਬੀ ਬਣਾ ਤੀ ਅਤੇ ਪੰਜਾਬੀ ਤੋਂ ਇੰਗਲਿਸ਼ ਇਸੇ ਤਰ੍ਹਾਂ ਨਾਲ ਹੀ ਕਈ ਕਈ ਰਾਜਾਂ ਵਿੱਚ ਅਲੱਗ ਅਲੱਗ ਹੀ ਭਾਸ਼ਾ ਬੋਲੀ ਜਾਂਦੀ ਹੈ ਅਤੇ ਦੋਵੇਂ ਭਾਸ਼ਾ ਹੀ ਸਮਝਣੀਆਂ ਜ਼ਰੂਰੀ ਹੁੰਦੀਆਂ ਹੈਗੀਆਂ ਅਤੇ ਬੋਲੀਆਂ ਵੀ ਜਾਂਦੀਆਂ ਹੈਗੀਆਂ ਜੇ ਆਪਾਂ ਬੋਲੀਏ ਤਾਂ